ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਜੀਵਨ ਕੌਰ ਹੈ ਅਤੇ ਮੈਂ ਤੁਹਾਡੇ ਤੋਂ ਪੰਦਰ੍ਹਾਂ ਦਿਨ ਪਹਿਲਾਂ ਇੱਕ ਬੋਟ ਕੰਪਨੀ ਦੇ ਹੈੱਡਫੋਨਜ਼ ਮੰਗਵਾਏ ਸੀ ਜੋ ਕਿ ਵਾਇਰਲੈਸ ਸੀਗੇ ਔਰ ਉਹ ਬਹੁਤ ਹੀ ਵਧੀਆ ਨੇ ਉਹਦੀ ਪੈਕਿੰਗ ਮੈਨੂੰ ਸਭ ਤੋਂ ਵਧੀਆ ਲੱਗੀ ਕਿ ਉਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਪੈਕ ਕੀਤੇ ਹੋਏ ਸੀ ਤਾਂ ਕਿ ਉਹ ਡੈਮੇਜ ਨਾ ਹੋ ਸਕੇ ਖਰਾਬ ਨਾ ਹੋ ਸਕੇ ਔਰ ਉਹ ਜਦੋਂ ਮੈਂ ਉਹਨੂੰ ਓਪਨ ਕੀਤਾ ਤਾਂ ਉਹ ਬੜੀ ਵਧੀਆ ਲੁੱਕ ਦੇ ਰਹੇ ਸੀਗੇ ਇੱਕ ਛੋਟੀ ਜਿਹੀ ਲੁੱਕ ਜਿਹਨੂੰ ਕਿ ਮੈਂ ਆਰਾਮ ਨਾਲ ਆਪਣਾ ਕਿਤੇ ਵੀ ਕੈਰੀ ਕਰਕੇ ਲੈ ਕੇ ਜਾ ਸਕਦੀ ਹਾਂ ਅਤੇ ਸੈਕਿੰਡ ਥਿੰਗ ਉਹਦੀ ਜਿਹੜੀ ਸਾਊਂਡ ਕੁਆਲਟੀ ਸੀਗੀ ਉਹ ਮੈਨੂੰ ਇੱਦਾਂ ਲੱਗ ਰਹੀ ਸੀ ਕਿ ਜਿਵੇਂ ਕਿ ਡੀ ਜੇ ਦੀ ਆਵਾਜ਼ ਹੁੰਦੀ ਏ ਇੰਨੀ ਅੱਛੀ ਸਾਊਂਡ ਕੁਆਲਟੀ ਸੀਗੀ ਕਿ ਮੈਨੂੰ ਬੜੀ ਵਧੀਆ ਲੱਗਿਆ ਓਨਾ ਈ ਅਤੇ ਤੀਜੀ ਚੀਜ਼ ਉਹਦੀ ਕਿ ਬੈਟਰੀ ਬੈਕਅਪ ਹੈ ਉਹ ਸਭ ਤੋਂ ਜ਼ਿਆਦਾ ਬੈਸਟ ਲੱਗੀ ਮੈਨੂੰ ਕਿਉਂਕਿ ਉਹਨੂੰ ਮੈਂ ਜੇ ਚਾਰ ਦਿਨ ਵੀ ਰੀ ਚਾਰਜ ਨਾ ਕਰਾਂ ਤਾਂ ਵੀ ਉਹ ਬੜਾ ਵਧੀਆ ਚੱਲ ਜਾਂਦੇ ਹੈ ਅਤੇ ਮੈਨੂੰ ਇੰਨੇ ਵਧੀਆ ਰੇਟ 'ਤੇ ਮਿਲ ਗਏ ਉਹ ਕਿ ਇੰਨੇ ਸਸਤੇ ਮੈਨੂੰ ਕਿਤੇ ਮਾਰਕਿਟ ਦੇ ਵਿੱਚ ਈਜ਼ੀਲੀ ਨਹੀਂ ਮਿਲ ਰਹੇ ਸੀਗੇ ਇਸ ਕਰਕੇ ਮੈਂ ਤੁਹਾਡੀ ਕੰਪਨੀ ਤੋਂ ਇਹ ਹੈੱਡਫੋਨਜ਼ ਮੰਗਵਾਏ ਸੀਗੇ ਜੋ ਕਿ ਸਿਰਫ ਮੈਨੂੰ ਹੀ ਨਹੀਂ ਮੇਰੇ ਦੋਸਤਾਂ ਨੂੰ ਅਤੇ ਮੇਰੇ ਘਰਦਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਏ ਧੰਨਵਾਦ ਜੀ